ਪੰਜਾਬ 'ਚ ਸਭ ਤੋਂ ਪਹਿਲਾਂ ਤਾਂ ਸਾਡੀ ਪ੍ਰਦੂਸ਼ਣ ਦਾ ਮੇਨ ਮੇਨ ਹੈਗਾ ਆਪਣਾ ਜੰਗਲਾਂ ਦੀ ਕਟਾਈ ਪੰਜਾਬ ਵਿੱਚ ਬਹੁਤ ਹੀ ਤੇਜ਼ੀ ਨਾਲ ਜੰਗਲਾਂ ਦੀ ਕਟਾਈ ਹੋ ਰਹੀ ਆ ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਮੇਨ ਕਰਕੇ ਕਈ ਸਕੀਮਾਂ ਚਲਾਈਆਂ ਹਨ ਜਿਸ ਵਿੱਚ ਕਿ ਪਿੰਡਾਂ ਪਿੰਡਾਂ ਜਾ ਕੇ ਮਨਰੇਗਾ ਮਨਰੇਗਾ ਵਾਲਿਆਂ ਨੂੰ ਦਰਖਤ ਦਿੱਤੇ ਜਾਂਦੇ ਹਨ ਛੋਟੇ ਬੂਟੇ ਦਿੱਤੇ ਜਾਂਦੇ ਹਨ ਅਤੇ ਪੇੜ ਪੌਦੇ ਦਿੱਤੇ ਜਾਂਦੇ ਜਿਸ ਕਰਕੇ ਜਿਸ ਨਾਲ ਕੀ ਉਹਨਾਂ ਦੀ ਦੇਖ ਰੇਖ ਦੇਖ ਰੇਖ ਲਈ ਉਹਨਾਂ ਦੀ ਖਾਤਰ ਇੱਕ ਆਦਮੀ ਵੀ ਰੱਖਿਆ ਜਾਂਦਾ ਹੈ ਜੋ ਕਿ ਉਹ ਪ੍ਰੋਪਰ ਉਹਨਾਂ ਦੀ ਦੇਖਰੇਖ ਕਰੇ ਉਹਨਾਂ ਨੂੰ ਪਾਣੀ ਦੇਵੇ ਉਹਨਾਂ ਦੀ ਸੰਭਾਲ ਸਾਂਭ ਸੰਭਾਲ ਕਰੇ ਇਸ ਤੋਂ ਬਿਨਾਂ ਹੋਰ ਕਈ ਸਕੀਮਾਂ ਚਲਾਈਆਂ ਹਨ ਜਿਵੇਂ ਕਿ ਪਾ ਪਾਣੀ ਦੀ ਕਮੀ ਦਿਨ ਪਰ ਦਿਨ ਵਧਦੀ ਰਹੀ ਹੈ ਇਸ ਲਈ ਪੰਜਾਬ ਸਰਕਾਰ ਐਵੇਂ ਕਰਦੀ ਹੈ ਕਿ ਘੱਟ ਤੋਂ ਘੱਟ ਟਿਊਵੈਲਾਂ ਦੇ ਯੂਜ ਕਰਕੇ ਨਹਿਰਾਂ ਨਹਿਰਾਂ ਦੇ ਥਰੂ ਪਾਣੀ ਪ੍ਰੋਵਾਈਡ ਕਰਵਾ ਰਹੀ ਕਿਸਾਨਾਂ ਨੂੰ ਜਿਸ ਨਾਲ ਕਿ ਟਿ ਟਿਊਬਵੈੱਲਾਂ ਟਿਊਬਵੈੱਲਾਂ ਥਰੂ ਪਾਣੀ ਨਾਲ ਨਿਕਾਲੇ ਜਾ ਸਕੇ ਇਸ ਤੋਂ ਬਾਅਦ ਜਿਹੜੀ ਜਲਵਾਯੂ ਜਿਹੜੀ ਆਪਣੀ ਪ੍ਰਦੂਸ਼ਣ ਹੈਗਾ ਉਹ ਹੈਗਾ ਏ ਹਵਾ ਪ੍ਰਦੂਸ਼ਣ ਹਵਾ ਪ੍ਰਦੂਸ਼ਣ ਜ਼ਿਆਦਾ ਹੁੰਦਾ ਆਪਣਾ ਇਹਦਾ ਜਿਵੇਂ ਕਿ ਕਿਸਾਨ ਝੋਨੇ ਤੋਂ ਬਾਅਦ ਪਰਾਲੀ ਸਾੜ ਦਿੰਦੇ ਹਨ ਇਸ ਨਾਲ ਹਵਾ ਪ੍ਰਦੂਸ਼ਣ ਬਹੁਤ ਹੁੰਦਾ ਹੈ ਇਸ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਬਹੁਤ ਵਧੀਆ ਸਕੀਮਾਂ ਚਲਾਈਆਂ ਹਨ ਜਿਸ ਵਿੱਚ ਕਿ ਕਿਸਾਨਾਂ ਨੂੰ ਉਹਨਾਂ ਦੀ ਸਬਸਿਡੀ ਦਿੱਤੀ ਜਾਂਦੀ ਹੈ ਜਿਸ ਨਾਲ ਕਿ ਉਹ ਪਰਾਲੀ ਨਾ ਸਾੜਨ ਅਤੇ ਉਸਦੇ ਪ੍ਰੋਪਰ ਰਹਿੰਦ ਖੁੰਹਦ ਕਰ ਸਕਣ ਸਰਕਾਰ ਮੌਕੇ ਮੌਕੇ ਸਿਰ ਕਈ ਸਕੀਮਾਂ ਖੋਲ੍ਹਦੀ ਹੈ ਜਿਸ ਨਾਲ ਕਿ ਪ੍ਰਦੂਸ਼ਨ ਘੱਟ ਤੋਂ ਘੱਟ ਕਰਿਆ ਜਾ ਸਕੇ ਇਸ ਲਈ ਪੰਜਾਬ ਸਰਕਾਰ ਬਹੁਤ ਹੀ ਵਧੀਆ ਸਕੀਮਾਂ ਚਲਾ ਰਹੀ ਹੈ ਜਿਸ ਨਾਲ ਕਿ ਅਸੀਂ ਉਹਨਾਂ ਦੇ ਲਾਭ ਉਠਾ ਕੇ ਪ੍ਰਦਰਸ਼ਨ ਨੂੰ ਕੰਟਰੋਲ ਕਰ ਸਕੀਏ ਧੰਨਵਾਦ